ਇਨਕਮ ਟੈਕਸ ਦਾ ਮਤਲਬ ਹੁੰਦਾ ਐ ਕਿ ਜਿਹੜੀ ਅਸਾਨੂੰ ਆਮਦਨ ਆਂਦੀ ਹੈ ਆਪਣੇ ਕੰਮ ਤੋਂ ਆਪਣੇ ਰੁਜਗਾਰ ਤੋਂ ਚਾਹੇ ਕੀ ਉਹ ਬਿਜਨਸ ਹੋਵੇ ਜਾਂ ਫੇਰ ਉਹ ਨੌਕਰੀ ਹੋਵੇ ਜਿਹੜੀ ਵੀ ਗਮੈਂਟ ਨੂੰ ਅਸੀਂ ਟੈਕਸ ਪੇਅ ਕਰਦੇ ਹਾਂ ਉਹਨੂੰ ਅਸੀਂ ਇਨਕਮ ਟੈਕਸ ਕਹਿਨੇ ਆਂ ਤੇ ਜੇ ਮੈਨੂੰ ਆਪਣੇ ਪਿਛਲੇ ਸਾਰੇ ਸਾਲਾਂ ਦੀ ਜਿਹੜੀ ਇਨਕਮ ਟੈਕਸ ਐ ਉਹ ਕਢਵਾਉਨੀ ਆਂ ਤਾਂ ਪਹਿਲੇ ਮੈਂ ਔਨਲਾਈਨ ਗੂਗਲ ਤੇ ਜਾ ਕੇ ਮੈਂ ਆਪਣੇ ਇਨਕਮ ਟੈਕਸ ਗਮੈਂਟ ਓਫ ਇੰਡੀਆ ਦੀ ਜਿਹੜੀ ਵੈਬਸਾਈਟ ਹੈਗੀ ਹੈ ਉਹਨੂੰ ਓਪਨ ਕਰਾਂਗੀ ਤੇ ਉੱਥੇ ਆਪਣੇ ਪਿਛਲੇ ਚਾਰ ਪੰਜ ਸਾਲ ਦੀ ਸਾਰੀ ਇਨਕਮ ਟੈਕਸ ਰਿਟਰਨ ਦੀ ਫਾਈਲ ਓਥੇ ਅਵੇਲੇਬਲ ਹੋਈ ਹੋਣਗੀਆਂ ਤੇ ਉਹਨੂੰ ਮੈਂ ਡਾਊਨਲੋਡ ਕਰਾਂਗੀ ਤੋ ਡਾਊਨਲੋਡ ਕਰਨ ਤੋਂ ਬਾਅਦ ਮੈਂ ਓਥੇ ਸਾਰੀ ਜਿਹੜੀ ਵੀ ਜਾਣਕਾਰੀ ਹੈ ਉੱਥੇ ਹਾਸਲ ਕਰਾਂਗੀ ਉਹਨੂੰ ਉਹਨੂੰ ਚੰਗੀ ਤਰ੍ਹਾਂ ਦੇਖਾਂਗੀ ਕੀ ਹਰ ਮਹੀਨੇ ਮੈਨੂੰ ਕਿੰਨੀ ਆਮਦਨ ਆਉਂਦੀ ਸੀਗੀ ਮੇਰੇ ਪਹਿਲੇ ਰੋਜਗਾਰ ਤੋਂ ਤੇ ਮੈਂ ਕਿੰਨਾ ਜਿਹੜਾ ਟੈਕਸ ਹੈ ਉਹ ਸਾਲ ਦਾ ਮੈਂ ਟੈਕਸ ਜਿਹੜਾ ਹੈਗਾ ਉਹ ਮੈਂ ਪੇਅ ਕਰਦੀ ਸੀਗੀ ਇਸਤੋਂ ਬਾਅਦ ਓਥੋਂ ਮੈਨੂੰ ਸਾਰੀ ਜਨ ਜਾਣਕਾਰੀ ਜਿਹੜੀ ਵੀ ਹੈਗੀ ਐ ਉਹ ਮਿਲ ਜਾਵੇਗੀ ਤੇ ਉਹ ਜਾਣਕਾਰੀ ਸਾਰੀ ਕੱਠੀ ਕਰਕੇ ਮੈਂ ਆਪਣੇ ਨਵੇਂ ਬਿਜਨਸ ਵਾਸਤੇ ਤੇ ਓਥੇ ਮੈਂ ਜਿਹੜੀ ਹੈਗੀ ਐ ਉਹਦੀ ਡਿਟੇਲ ਸਬਮਿਟ ਕਰ ਦਵਾਂਗੀ